ਹੈਲੋ ਹਾਂਜੀ ਹਾਂਜੀ ਹਾਂਜੀ ਬੋਲੋ ਜੀ ਸਿੱਧੂ ਮੂਸੇਵਾਲਾ ਜੀ ਬਾਰੇ ਜੀ ਹਾਂਜੀ

ਦੇਖੋ ਜੀ ਹਾਂਜੀ ਹਾਂਜੀ ਜ਼ਰੂਰ ਵੈਸੇ ਤਾਂ ਜੀ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਜੇ ਆਪਾਂ ਡਿਸਕਸ਼ਨ ਕਰਨ ਲੱਗ ਜਾਈਏ ਉਹਨਾਂ ਬਾਰੇ ਉਹਨਾਂ ਸ਼ਖਸੀਅਤ ਬਾਰੇ ਆਪਾਂ ਨੂੰ ਫੋਨ 'ਤੇ ਵੀ ਮੰਨ ਲਓ ਵੀ ਸਾਰਾ ਦਿਨ ਵੀ ਲੱਗ ਸਕਦਾ ਐਡੇ ਮਹਾਨ ਸ਼ਖਸ਼ੀਅਤ ਸੀ ਸਨ ਉਹ ਪਰ ਫਿਰ ਵੀ ਮੈਂ ਤੁਹਾਨੂੰ ਉਹਨਾਂ ਦੇ ਨਾਲ ਮਿਲਦੀਆਂ ਜੁਲਦੀਆਂ ਮੰਨ ਲਓ ਵੀ ਕਹਾਣੀ ਉਹਨਾਂ ਦੀ ਤੁਹਾਨੂੰ ਦੱਸ ਦਿੰਦਾ ਗਾ ਹਾਂ ਉਹ ਨਾ ਜੀ ਮੰਨ ਲਓ ਮੇਰਾ ਕਲੋਜ ਫਰੈਂਡ ਉਹਨਾਂ ਦੇ ਕੋਲ ਹੀ ਰਿਹਾ ਮੂਸੇ ਪਿੰਡ ਦੇ ਕੋਲ ਹੀ ਸੀ ਮੇਰਾ ਪਿੰਡ ਅਤੇ ਉਹਨਾਂ ਨੂੰ ਮੰਨ ਲਓ ਵੀ ਸ਼ੁਰੂ ਤੋਂ ਹੀ ਮਨ ਲਓ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਸਿੰਗਿੰਗ ਦਾ ਅਤੇ ਖੇਤੀਬਾੜੀ ਦਾ ਜੀ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਉਹ ਦੇਖੋ ਨਾਲੇ ਤਾਂ ਜੀ ਉਹ ਮੰਨ ਲਓ ਵੀ ਉਹਨਾਂ ਨੇ ਦੇਖੋ ਐਜੂਕੇਸ਼ਨ 'ਚ ਵੀ ਉਹ ਕਿਤੇ ਉਹ ਐਂ ਉਹ ਨਹੀਂ ਸੀਗੇ ਵਿੱਚ ਕਹਿ ਦਿੰਦੇ ਨੇ ਵੀ ਘੱਟ ਘੱਟ ਪੜ੍ਹੇ ਲਿਖੇ ਹਾਂ ਲੁਧਿਆਣਾ ਤੋਂ ਦੇਖ ਲਓ ਇੰਜੀਨੀਅਰਿੰਗ ਕੀਤੀ ਹੋਈ ਸੀ ਉਹਨਾਂ ਦੀ ਹਾਂ ਬਾਕੀ ਉਹਨਾਂ ਦਾ ਜੀ ਲਿਖਣ ਦਾ ਢੰਗ ਸੀ ਨਾ ਉਹ ਬਹੁਤ ਹੀ ਮੰਨ ਲਓ ਤੁਹਾਨੂੰ ਪਤਾ ਹੀ ਹੈ ਜੀ ਸਾਰੀ ਦੁਨੀਆਂ ਹੀ ਜਾਣਦੀ ਆ ਹਾਂ ਉਹ ਵੱਖਰੇ ਸੀ ਉਹਨਾਂ ਵਰਗਾ ਕੋਈ ਨਹੀਂ ਸੀ ਹਾਂ ਹੋਰ ਬਾਕੀ ਕੋਈ ਗੱਲ ਨਹੀਂ ਜੀ ਸ ਉਹਨਾਂ ਦੇ ਦੇਖੋ ਮੈਂ ਤੁਹਾਨੂੰ ਛੋਟਾ ਜਿਹਾ ਕਿੱਸਾ ਸੁਣਾ ਦਿੰਦਾ ਜੀ ਉਹਨਾਂ ਦੇ ਨਾ ਬੈਕਗਰਾਉਂਡ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗਾ ਜੀ ਉਹ ਬਿਲਕੁਲ ਗਰਾਊਂਡ ਲੈਵਲ ਜੀਰੋ ਲੈਵਲ ਤੋਂ ਉੱਠੇ ਹੋਏ ਇਨਸਾਨ ਸਨ ਜੀ ਸਿੱਧੂ ਮੂਸੇਵਾਲਾ ਅਤੇ ਦੇਖ ਲਓ ਅੱਜ ਉਹਨਾਂ ਦਾ ਨਾਮ ਪੂਰੀ ਦੁਨੀਆਂ 'ਚ ਫੇਮਸ ਹੈ ਉਹਨਾਂ ਨੇ ਆਪਦੇ ਕਾਬਲੀਅਤ ਦੇ ਦਮ 'ਤੇ ਇੰਨਾਂ ਆਪਣਾ ਆਪਣੇ ਮਾਤਾ ਪਿਤਾ ਦਾ ਸਾਡੇ ਇਲਾਕੇ ਦਾ ਮਾਨਸਾ ਦਾ ਮੂਸੇ ਦਾ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜੀ ਹਾਂਜੀ ਹਾਂਜੀ ਉਹਨਾਂ ਦਾ ਪਹਿਲਾ ਗਾਣਾ ਆਇਆ ਸੀਗਾ ਜੀ ਸੋ ਹਾਈ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ